ਇਹ ਗੱਲ ਮੰਨਣ ਯੋਗ ਹੈ ਕਿ ਬਦਲ ਰਹੀ ਟੈਕਨੋਲੋਜੀ ਦਾ ਕਰਕੇ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਬਿਲਕੁਲ ਨਹੀਂ ਹੈ ਕਿਉਕਿ ਹਰੇਕ ਦੇ ਹੱਥ ਦੇ ਵਿੱਚ ਲੈਪਟੋਪ ਮੋਬਾਈਲ ਜਿਹਦੇ ਉੱਤੇ ਗੇਮਾਂ ਖੇਡਦੇ ਰਹਿੰਦੇ ਜਾਂ ਸਕੂਲ ਦਾ ਕੰਮ ਜੋ ਵੀ ਐਜੂਕੇਸ਼ਨ ਜ਼ਰੂਰੀ ਆ ਉਹ ਆਪਣਾ ਮੋਬਾਇਲ ਤੋਂ ਜਾਂ ਲੈਪਟੋਪ ਤੋਂ ਹੀ ਲੈਣਾ ਪਸੰਦ ਕਰਦੇ ਆ ਅਤੇ ਗਰਾਉਂਡ ਦੇ ਵਿੱਚ ਜਾ ਕੇ ਖੇਡਣਾ ਪਸੰਦ ਨਹੀਂ ਕਰਦੇ ਗਰਾਊਂਡ ਵਿੱਚ ਜਾ ਕੇ ਖੇਡਣ ਦੇ ਨਾਲ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਮਿਲਦੀ ਜੋ ਕਿ ਘਰ ਵਿੱਚ ਬੈਠ ਕੇ ਮੋਬਾਇਲ 'ਤੇ ਜਾਂ ਲੈਪਟੋਪ 'ਤੇ ਉਹ ਤੰਦਰੁਸਤ ਸਰੀਰ ਨਹੀਂ ਉਹਨਾਂ ਨੂੰ ਮਿਲਦਾ ਜਿਹਦਾ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਬੱਚਿਆਂ ਨੂੰ ਲੱਗ ਰਹੀਆਂ ਹਨ ਜੇਕਰ ਉਸ ਜਾ ਕੇ ਗਰਾਉਂਡ ਦੇ ਵਿੱਚ ਖੇਡਣਗੇ ਤਾਂ ਬਿਮਾਰੀਆਂ ਤੋਂ ਵੀ ਬਚਣਗੇ ਸਰੀਰ ਵੀ ਤੰਦਰੁਸਤ ਹੋਵੇਗਾ ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਬਾਪ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਪ੍ਰੇਰਿਤ ਕਰਨ ਕਿ ਗਰਾਉਂਡ ਦੇ ਵਿੱਚ ਜਾ ਕੇ ਆਪਣੀ ਖੇਡ ਮਨ ਪਸੰਦ ਖੇਡ ਚੁਣਨ ਅਤੇ ਆਪਣਾ ਗਰਾਉਂਡ ਦੇ ਵਿੱਚ ਵੱਧ ਤੋਂ ਵੱਧ ਸਮਾਂ ਜਿਹੜਾ ਵਾ ਲਗਾਉਣ ਤਾਂ ਕਿ ਉਹ ਉਹਨਾਂ ਦਾ ਸਰੀਰ ਤੰਦਰੁਸਤ ਰਹਿ ਸਕੇ